ਜਦੋਂ ਮੈਂ ਪਹਿਲੀ ਵਾਰੀ ਭੰਗੜਾ ਕੀਤਾ ਸੀ ਸਕੂਲ ਦੇ ਵਿੱਚ ਤਾਂ ਸਾਨੂੰ ਸਲਵਾਰ ਸੂਟ ਪਾਇਆ ਗਿਆ ਸੀ ਨਾਲ ਪਰਾਂਦਾ ਲਟਕਣ ਪਾਏ ਸੀਗੇ ਲੋਟੀਆਂ ਜਿਹਨਾਂ ਨੂੰ ਕਹਿ ਸਕਦੇ ਹਾਂ ਆਪਾਂ ਅਤੇ ਮਾਂਗ ਟਿੱਕਾ ਲਾਇਆ ਸੀਗਾ ਸੱਗੀ ਫੁੱਲ ਵੀ ਲਵਾਏ ਸੀ ਕਈਆਂ ਛੋਟੀਆਂ ਮਤਲਬ ਕਿਸੇ ਕਿਸੇ ਦੇ ਲਵਾਏ ਸੀ ਹਰ ਕਿਸੇ ਦੇ ਨਹੀਂ ਲਵਾਏ ਅਤੇ ਉਹਨਾਂ ਦੇ ਵਿੱਚ ਜਿਹੜਾ ਪਹਿਰਾਵਾ ਆਕਰਸ਼ਿਤ ਕਰਦਾ ਕਿਉਂਕਿ ਜਦੋਂ ਆਪਾਂ ਭੰਗੜਾ ਕਰਦੇ ਹਾਂ ਉਹਦੇ ਵਿੱਚ ਮੇਨ ਚੀਜ਼ ਹੁੰਦੀ ਹੈ ਪਹਿਰਾਵਾ ਪਹਿਰਾਵਾ ਬਹੁਤ ਜ਼ਰੂਰੀ ਆ ਜੇ ਅਸੀਂ ਬਿਨਾਂ ਪਹਿਰਾਵੇ ਤੋਂ ਭੰਗੜਾ ਕਰੀਏ ਤਾਂ ਉਹਦੇ ਵਿੱਚ ਉਹ ਲੁੱਕ ਹੀ ਨਹੀਂ ਆਉਂਦੀ ਉਹ ਪੰਜਾਬੀਆਂ ਦੀ ਸ਼ਾਨ ਹੀ ਨਹੀਂ ਆਉਂਦੀ ਉਹਦੇ 'ਚ ਬਸ ਇਹੀ ਲੱਗਦਾ ਕਿ ਹਾਂਜੀ ਇੱਦਾਂ ਕਰੀ ਜਾਂਦੇ ਆ ਅਤੇ ਕੀ ਵੇਖਣਾ ਜਦੋਂ ਪਹਿਰਾਵਾ ਪਾ ਕੇ ਭੰਗੜਾ ਕੀਤਾ ਜਾਂਦਾ ਉਹਦੀ ਤਾਂ ਫਿਰ ਸ਼ ਸ਼ਾਨ ਹੀ ਵੱਖਰੀ ਹੁੰਦੀ ਆ ਉਹਦੇ ਮਜ਼ੇ ਹੀ ਵੱਖਰੇ ਹੁੰਦੇ ਆ ਅਤੇ ਮੁੰਡਿਆਂ ਲਈ ਪੋਸ਼ਾਕਾਂ ਜਿਹੜੀਆਂ ਪਹਿਰਾਵਾ ਹੁੰਦਾ ਉਹ ਹੁੰਦਾ ਧੋਤੀ ਕੁੜਤਾ ਅਤੇ ਉਹ ਵੀ ਜਦੋਂ ਪਾ ਕੇ ਜਦੋਂ ਭੰਗੜਾ ਕਰਦੇ ਆ ਨਾ ਉਦੋਂ ਤਾਂ ਚਾਰ ਚੰਨ ਲੱਗ ਜਾਂਦੇ ਭੰਗੜੇ ਨੂੰ ਮਤਲਵ ਇੰਨਾਂ ਸੋਹਣਾ ਲੱਗਦਾ ਨਾ ਉਹ ਉਹਨੂੰ ਐਕਸਪਲੇਨ ਕਰਨਾ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਿਲ ਆ ਇਹ ਚੀਜ਼ ਨਹੀਂ ਹੋ ਸਕਦੀ ਆਖਰਸ਼ਿਤ ਜਦੋਂ ਉਹ ਇਹ ਪਹਿਰਾਵਾ ਪਾ ਕੇ ਅਤੇ ਸੱਜ ਧੱਜ ਕੇ ਆਉਂਦੇ ਆ ਨਾ ਪੂਰੇ ਪੰਜਾਬੀ ਸੱਭਿਆਚਾਰ ਕਿਉਂਕਿ ਭੰਗੜਾ ਜਿਹੜਾ ਹੈਗਾ ਉਹ ਪੰਜਾਬੀ ਸੱਭਿਆਚਾਰ ਦਾ ਇੱਕ ਹਿੱਸਾ ਅਤੇ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਉਹਨਾਂ ਦਾ ਪਹਿਰਾਵਾ ਵੀ ਬਹੁਤ ਜ਼ਰੂਰੀ ਹੈ ਜਦੋਂ ਪਹਿਰਾਵਾ ਪਾ ਕੇ ਆਉਂਦੇ ਆ ਉਹ ਇਹਨਾਂ ਆਕਰਸ਼ਿਤ ਕਰਦੇ ਆ ਕਿ ਜਦੋਂ ਜਿਹੜਾ ਸਾਹਮਣੇ ਵਾਲਾ ਬੰਦਾ ਦੇਖਦਾ ਨਾ ਉਹਨਾਂ ਨੂੰ ਕਿ ਹਾਂ ਲੱਗੇ ਕਿ ਜੀ ਇਹ ਅਸਲੀ ਪਰਫੋਮੰਸ ਜੀ ਇਹ ਰੰਗੀਲਾ ਪੰਜਾਬ ਆ ਇਹ ਅਸਲੀ ਪੰਜਾਬ ਦੀ ਜਿਹੜੀ ਪਹਿਚਾਣ ਆ ਉਹ ਪਹਿਰਾਵਾ ਹੀ ਆ ਉਹਨੂੰ ਵੇਖ ਕੇ ਹੀ ਅਸੀਂ ਸਭ ਕੁਛ ਕਰ ਸਕਦੇ ਹਾਂ ਜੇ ਅਸੀਂ ਇੱਦਾਂ ਹੀ ਵੀ ਵਲੋਟ ਸ਼ਰਟ ਪਾ ਕੇ ਆ ਜਾਈਏ ਜਾਂ ਫਿਰ ਪੈਂਟ ਸ਼ਰਟ ਪਾ ਕੇ ਆ ਜੀਏ ਭੰਗੜਾ ਕਰਨ ਉਹਦੇ ਵਿੱਚ ਉਹ ਗੱਲ ਨਹੀਂ ਬਣੀ ਨਾ ਉਹ ਆਕਰਸ਼ਿਤ ਨਹੀਂ ਹੋਣਾ ਤਾਂ ਸਾਨੂੰ ਆਕਰਸ਼ਿਤ ਹੋਣਾ ਬਹੁਤ ਜ਼ਰੂਰੀ ਹੈ